ਓਲਾ ਕੈਬ ਤੋਂ ਰਜਿੰਦਰ ਬੋਲਦਾ ਹਾਂ ਰਾਜੇ ਮੈਂ ਤੈਨੂੰ ਪਹਿਲਾਂ ਵੀ ਲੈ ਗਿਆ ਇੱਕ ਦਿਨ ਚੰਡੀਗੜ੍ਹ ਹਾਂ ਤੇ ਆਪਾਂ ਨੇ ਨਾ ਹੁਣ ਇੱਧਰ ਜਾਣਾ ਆਪਣਾ ਬਨੂੜ ਵਾਲੀ ਸਾਈਡ ਜਾਣਾ ਹਾਂ ਅਤੇ ਆਪਾਂ ਨੇ ਜਾਣਾ ਸਵੇਰੇ ਨੌ ਵਜੇ ਅਤੇ ਕਿੰਨੇ ਵਜੇ ਪਹੁੰਚ ਜਾਵੇਗਾ ਤੂੰ ਸਾਢੇ ਅੱਠ ਨਹੀਂ ਨਹੀਂ ਆਪਾਂ ਨੇ ਨੌਂ ਵਜੇ ਤਾਂ ਪਹੁੰਚ ਜਾਣਾ ਆਪਾਂ ਨੇ ਹਾਂ ਤੂੰ ਐ ਕਰੀ ਪੌਣੇ ਕੁ ਅੱਠ ਪੌਣੇ ਕੁ ਨੌ ਵਜੇ ਆ ਜਾਵੀ ਹਾਂ ਹਾਂ ਅਤੇ ਫਿਰ ਆਪਾਂ ਇੱਥੋਂ ਚੱਲ ਪਵਾਂਗੇ ਅਤੇ ਟਰੈਫਿਕ ਕਿਹੜੇ ਕਿਹੜੇ ਪਾਸੇ ਜ਼ਿਆਦਾ ਹੁੰਦੀ ਹੈ ਰਾਏਪੁਰਾ ਬਾਈਪਾਸ ਕੋਲ ਜ਼ਿਆਦਾ ਹੁੰਦੀ ਆ ਹਾਂ ਕਈ ਵਾਰ ਜਾਮ ਵੀ ਲੱਗ ਜਾਂਦਾ ਉੱਧਰ ਨੂੰ ਅਤੇ ਆਪਾਂ ਨੇ ਐ ਕਰਨਾ ਵੀ ਇਹ ਦੇਖ ਲਈ ਵੀ ਆਪਾਂ ਨੂੰ ਜੇ ਟਰੈਫਿਕ ਜ਼ਿਆਦਾ ਹੋਈ ਤਾਂ ਆਪਾਂ ਨੇ ਰਾ ਸ਼ੋਟ ਕਟ ਰਸਤਾ ਲੱਭਣਾ ਹਾਂ ਓ ਹੋ ਸ਼ਾਰਟ 'ਚ ਨੂੰ ਜਾਣਾ ਪੈਣਾ ਆਪਾਂ ਨੂੰ ਫਿਰ ਜਲਦੀ ਹਾਂ ਵਾ ਦੇਖ ਲਈ ਕਿੱਦਾਂ ਕਰਨਾ ਅਤੇ ਬਸ ਜਲਦੀ ਆ ਜਾਂਈਂ

ਹਾਂ ਅਤੇ ਬਸ ਆਪਣਾ ਉੱਥੇ ਦੋ ਘੰਟੇ ਲੱਗਣੇ ਆ ਦੋ ਘੰਟੇ ਫਿਰ ਵਾਪਸੀ ਸਾਨੂੰ ਛੱਡ ਦੀ ਹਾਂ ਹਾਂ ਦੁਪਹਿਰ ਜਿਹੇ ਨੂੰ ਉਹ ਹੀ ਦਸ ਗਿਆਰਾਂ ਵੱਜ ਜਾਣਗੇ ਵਾਪਸੀ ਦੇ ਹਾਂਜੀ ਹਾਂ ਅਤੇ ਗੱਡੀ ਵਧੀਆ ਹੋਵੇ ਸਾਫ਼ ਸੁਥਰੀ ਠੀਕ ਹੈ ਹਾਂਜੀ ਹਾਂ ਬਸ ਦੋ ਜਾਣੇ ਜਾਵਾਂਗੇ ਹਸਬੈਂਡ ਵਾਈਫ

ਹਾਂ ਰਾਜੇ ਅਤੇ ਉਹ ਪੈਸੇ ਕਿੰਨੇ ਲਓਗੇ ਤੁਸੀਂ ਤੁਸੀਂ ਪਹਿਲਾਂ ਪੰਦਰਾਂ ਸੌ ਲਿਆ ਸੀ ਹਾਂ ਬਨੂੜ ਤੋਂ ਪਹਿਲਾਂ ਹੀ ਆ ਚਲੋ ਉਸ ਤੋਂ ਬਾਰਾਂ ਪੰਦਰਾਂ ਕਿਲੋਮੀਟਰ ਪਹਿਲਾਂ ਹੀ ਆ ਨਹੀਂ ਹਜ਼ਾਰ ਕੁ ਰੁਪਏ ਦੇ ਦੇਈਏ ਤੁਹਾਨੂੰ ਹਾਂ ਹਜ਼ਾਰ ਕੁ ਰੁਪਏ ਦੇਦਾਗੇ ਕੋਈ ਗੱਲ ਨਹੀਂ ਠੀਕ ਹੈ ਰਾਜੇ ਹਾਂ ਟਾਈਮ ਨਾਲ ਆਜੀ ਬਸ ਹਾਂ ਗੱਡੀ ਵਾ ਛੋਟੀ ਲੈ ਆਂਈ ਚਾਹੇ ਜਿਹੜੀ ਮਰਜ਼ੀ ਲੈ ਆਂਈ ਛੋਟੀ ਲੈ ਆਂਈ ਬਸ ਸਾਫ਼ ਸੁਥਰੀ ਗੱਡੀ ਹੋਵੇ ਹਾਂ ਹਾਂ ਵਾ ਕੋਈ ਤੰਗ ਨਾ ਕਰੇ ਰਾਸਤੇ 'ਚ ਕੋਈ ਪ੍ਰੋਬਲਮ ਨਾ ਆਵੇ ਨਾ ਗੱਡੀ 'ਚ ਥੋੜ੍ਹੀ ਨਵੀਂ ਜਿਹੀ ਹੋਵੇ ਗੱਡੀ ਵਧੀਆ ਹੋਵੇ ਬਸ ਉਂ ਤਾਂ ਉਹਦਾ ਤੁਹਾਡੇ ਕੋਲ ਕਈ ਗੱਡੀਆਂ ਆ ਪਤਾ ਮੈਨੂੰ ਹਾਂ ਬਸ ਹਾਂ ਇੱਧਰੋ ਯੂਨੀਵਰਸਿਟੀਓ ਨਿਕਲ ਜਾਂਗੇ ਆਪਾਂ ਸਿੱਧਾ

ਠੀਕ ਆ ਤੁਸੀਂ ਮੈਨੂੰ ਸਾਹਮਣੇ ਦੁਪਹਿਰ ਨੂੰ ਬਸ ਉਹ ਹੀ ਬਾਰਾਂ ਕੁ ਵਜੇ ਵਾਪਸੀ ਡਰੋਪ ਕਰ ਦੇਣਾ ਠੀਕ ਹੈ ਹਾਂ ਠੀਕ ਹੈ ਰਾਜੇ ਓਕੇ